ਜਿਵੇਂ ਕਿ ਫਤਿਹਗੜ੍ਹ ਸਾਹਿਬ ਬੜਾ ਦਰਬਾਰ ਸਾਹਿਬ ਤੋਂ ਜਾਣ ਤੋਂ ਪਹਿਲਾਂ ਦੁਕਾਨਾਂ ਨੇ ਛੋਟੀਆਂ ਛੋਟੀਆਂ ਦੁਕਾਨਾਂ ਨੇ ਉੱਥੇ ਸਾਨੂੰ ਜਦੋਂ ਅੰਮ੍ਰਿਤ ਪਾਨ ਕਰਨ ਤੋਂ ਕਰਨਾ ਹੋਵੇ ਤਾਂ ਸਾਨੂੰ ਉੱਥੋਂ ਕੜਾ ਕਛਹਿਰਾ ਸਾਹਿਬ ਸ਼੍ਰੀ ਸਾਹਿਬ ਬਰਸਾ ਸਾਹਿਬ ਇਹੋ ਜਿਹੀਆਂ ਚੀਜ਼ਾਂ ਮਿਲ ਜਾਂਦੀਆਂ ਹਨ ਜਿਸ ਨਾਲ ਉਹਨਾਂ ਦਾ ਵੀ ਕਾਰੋਬਾਰ 'ਚ ਵਾਧਾ ਹੁੰਦਾ ਅਤੇ ਸਾਨੂੰ ਸਹੂਲਤ ਮਿਲ ਜਾਂਦੀ ਹੈ ਅਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਕਰਾਉਂਦੇ ਹਾਂ ਕਿ ਅਸੀਂ ਰੋਜਾਨਾ ਇਹ ਚੀਜ਼ਾਂ ਅਭਿਆਸ ਕਰਨ ਵਿੱਚ ਸਾਡੇ 'ਚ ਯੋਗਦਾਨ ਪਾਉਂਦੀਆਂ ਹਨ